ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਆਪਣੇ ਰੇਖਾ ਬੋਲ ਰਹੀ ਗੁਰਦਾਸਪੁਰ ਤੋਂ ਯੋਗ ਦੇ ਅਭਿਆਸ ਬਾਰੇ ਦੱਸਣਾ ਚਾਹੁੰਦੀ ਹਾਂ ਭਾਵਨਾ ਕਿਵੇਂ ਭਾਵਨਾ ਬਾਰੇ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਬਹੁਤ ਪ੍ਰੋਬਲਮ ਸੀਗੀਆਂ ਮੈਨੂੰ ਸਰਵਾਈਕਲ ਸੀ ਮੈਨੂੰ ਮਾਈਗਰੇਨ ਸੀ ਮੈਨੂੰ ਬੈਕ ਪੇਨ ਸੀ ਮੈਂ ਹੋਲੀ ਹੋਲੀ ਐਕਸਰਸਾਈਜ ਪਹਿਲਾਂ ਅੱਧਾ ਘੰਟਾ ਸ਼ੁਰੂ ਕਰ ਕੇ ਦੋ ਘੰਟੇ ਤੱਕ ਕਰਦੀ ਹਾਂ ਕਿ ਐਕਸਰਸਾਈਜ਼ ਦਾ ਮੈਨੂੰ ਬਹੁਤ ਫਰਕ ਪਿਆ ਵਾ ਮੇਰੀ ਬੈਕ ਪੇਨ ਵੀ ਘੱਟ ਗਈ ਆ ਬਾਕੀ ਜਿਹੜੇ ਖੜੇ ਹੋਣ ਵਾਲਾ ਆਸਣ ਉਹਦੇ ਨਾਲ ਮੈਨੂੰ ਝਟਕੇ ਲੱਗਦੇ ਸੀ ਪਹਿਲੇ ਥੋੜ੍ਹੇ ਦਿਨ ਝਟਕੇ ਲੱਗਦੇ ਰਹੇ ਉਸ ਤੋਂ ਬਾਅਦ ਮੈਂ ਬਿਲਕੁਲ ਠੀਕ ਹੋ ਗਈ ਆਪਣੇ ਆਪ ਨੂੰ ਇਕਦਮ ਸੰਭਾਲ ਲਿਆ ਹੁਣ ਮੈ ਠੀਕ ਤਰ੍ਹਾਂ ਅਕਸਰਸਾਇਜ ਕਰਦੀ ਹਾਂ ਕੋੋਈ ਮੈਨੂੰ ਝਟਕਾ ਨਹੀਂ ਲੱਗਦਾ ਹੋਰ ਕੁਝ ਨਹੀਂ ਹੁੰਦਾ ਮੇਰੇ ਬਹੁਤ ਪ੍ਰੋਬਲਮ ਹੱਲ ਹੋਈਆਂ ਜਿਵੇਂ ਕਿ ਸਰਵਾਈਕਲ ਮਾਈਗਰੇਨ ਬੈਕ ਪੇਨ ਕਿ ਮੈਨੂੰ ਔਰ ਸ਼ੂਗਰ 'ਚ ਵੀ ਮੈਨੂੰ ਮੈਂ ਥੋੜ੍ਹਾ ਠੀਕ ਮਹਿਸੂਸ ਕਰਦੀ ਹਾਂ ਘੱਟ ਗਈ ਆ ਦ ਸ਼ਾਮ ਨੂੰ ਮੈ ਵਰਕਆਉਟ ਵੀ ਕਰਦੀ ਹਾਂ ਥੋੜ੍ਹੀ ਐਕਸਰਸਾਈਜ਼ ਸ਼ਾਮ ਨੂੰ ਵੀ ਮੈਂ ਅੱਗੇ ਮੈਂ ਇੱਕ ਟਾਈਮ ਕਰਦੀ ਹੁਣ ਮੈਂ ਦੋ ਟਾਈਮ ਐਕਸਰਸਾਈਜ਼ ਕਰਦੀ ਹਾਂ ਐਕਸਰਸਾਈਜ ਮੈਨੂੰ ਬਹੁਤ ਫਰਕ ਪਿਆ ਪਹਿਲਾ ਮੈਨੂੰ ਝਟਕੇ ਸੀ ਮੈਂ ਇਕਦਮ ਆਪਣੇ ਸੰਭਾਲ ਲਏ ਆ ਹੁਣ ਬਿਲਕੁਲ ਠੀਕ ਆ ਮੈਨੂੰ ਬਹੁਤ ਫਰਕ ਪਿਆ ਇਸ ਕਰਕੇ ਐਕਸਰਸਾਈਜ ਜ਼ਰੂਰੀ ਹੈ ਬਾਕੀ ਮੈਨੂੰ ਰਣਨੀਤੀ ਆਹੀ ਆ ਮੇਰੀਆਂ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੂੰ ਆਪਣੀਆਂ ਭੈਣਾਂ ਨੂੰ ਨਾਲ ਜੋੜ ਲਾਂ ਤਾਂ ਕਿ ਜਿਸ ਜਿਵੇ ਮੈਨੂੰ ਫਰਕ ਪਿਆ ਹੋਣਾ ਉਹਨਾਂ ਨੂੰ ਵੀ ਫਰਕ ਪੈ ਸਕੇ ਐ ਕਿ ਉਹਨਾਂ ਨੂੰ ਵੀ ਫਰਕ ਪਏਗਾ ਅਤੇ ਉਹ ਵੀ ਮੇਰੇ ਨਾਲ ਐਕਸਰਸਾਈਜ ਕਰਨਗੀਆਂ ਮੈਂ ਰੋਜ਼ ਡੇਲੀ ਐਕਸਰਸਾਈਜ਼ ਕਰਨ ਜਾਨੀ ਹਾਂ ਸਾਡੇ ਲਾਗੇ ਇੱਕ ਹੋਲ ਆ ਉਥੇ ਟਰੇਨਰ ਆਉਂਦੀ ਆ ਉਹ ਵੀ ਯੋਗਾ ਵੀ ਕਰਵਾਉਂਦੀ ਆ ਉਥੇ ਵੀ ਜਾਨੀ ਆ ਅਤੇ ਐਕਸਰਸਾਈਜ ਮੈਨੂੰ ਬਹੁਤ ਵਧੀਆ ਲੱਗਦੀ ਆ ਐਕਸਰਸਾਈਜ ਨਾਲ ਮੇਰਾ ਸਰੀਰ ਇਕਦਮ ਠੀਕ ਹੋ ਗਿਆ ਅਤੇ ਮੈਂ ਬਹੁਤ ਪ੍ਰੋਬਲਮ 'ਚ ਸੀ ਹੁਣ ਮੈ ਚਲੋ ਚਲੋ ਠੀਕ ਆ ਕਿ ਮੈਂ ਆਪਣੇ ਆਪ ਤੁਰ ਫਿਰ ਸਕਦੀ ਮੈਨੂੰ ਬੈਕ ਪੇਨ ਨਹੀ ਆ ਮੈਂ ਘਰ ਦਾ ਕੰਮ ਕਰਦੀ ਹਾਂ ਅਤੇ ਮੈਨੂੰ ਕੋਈ ਤਕਲੀਫ ਨਹੀਂ ਹੁੰਦੀ ਕਿ ਮੈਂ ਬਹੁਤ ਵਧੀਆ ਹਾਲਤ ਹੈਗੀ ਆਲਸ ਮੇਰਾ ਚਲ ਗਿਆ ਇਹਦੇ ਤੋਂ ਹਾਂਜੀ